ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹੋਰ ਕਿਆ ਹਾਂਜੀ ਮੈਂ ਨਾ ਅਭੈਜੀਤ ਦੀ ਮੰਮਾ ਬੋਲ ਰਹੀ ਹਾਂ ਹਾਂਜੀ ਹਾਂਜੀ ਠੀਕ ਹੈ ਅਤੇ ਅਭੈਜੀਤ ਦਾ ਮੈਂ ਰਿਜਲਟ ਲੈਣ ਆਈ ਸੀਗੀ ਅਤੇ ਹਾਂਜੀ ਕਿਵੇਂ ਮਤਲਬ ਦੱਸਿਓ ਕਿੱਦਾਂ ਇਹ ਮਤਲਬ ਰਿਜਲਟ ਦਿਖਾਓ ਨਾਲੇ ਪੜ੍ਹਾਈ 'ਚ ਕਿਵੇਂ ਆ ਨੰਬਰ ਕਿੱਦਾਂ ਕਿੱਦਾਂ ਆਏ ਨੇ ਇਹਦੇ

ਹਾਂਜੀ ਹਾਂ ਹਾਂ ਹਾਂਜੀ ਅੱਛਾ

ਹਾਂਜੀ ਠੀਕ ਹੈ